ਰਵਾਇਤੀ ਪੰਜਾਬੀ ਜੁੱਤੀਆਂ ਬਣਾਉਣ ਦੀ ਕਲਾ ਦਾ ਵਰਣਨ ਕਰੋ ਜਿਵੇਂ ਕਿ ਪੰਜਾਬੀ ਸੱਭਿਆਚਾਰ ਵਿੱਚ ਪੰਜਾਬੀ ਪਹਿਰਾਵੇ ਦਾ ਬਹੁਤ ਮਹੱਤਵ ਹੈ ਪੰਜਾਬੀ ਪਹਿਰਾਵੇ ਵਿੱਚ ਕੁੜਤਾ ਪਜਾਮਾ ਕੁੜਤਾ ਚਾਦਰਾ ਅਤੇ ਪੰਜਾਬੀ ਜੁੱਤੀ ਦਾ ਖਾਸ ਮਹੱਤਵ ਹੈ ਪੰਜਾਬੀ ਜੁੱਤੀ ਪੰਜਾਬੀਆਂ ਦੀ ਸ਼ਾਨ ਹੈ ਪਹਿਲੇ ਪੰਜਾਬ ਵਿੱਚ ਪੰਜਾਬੀ ਜੁੱਤੀ ਦਾ ਖਾਸ ਮਹੱਤਵ ਸੀ ਪੁਰਾਣੇ ਲੋਕ ਜ਼ਿਆਦਾਤਰ ਪੰਜਾਬੀ ਜੁੱਤੀਆਂ ਹੀ ਪਹਿਨਦੇ ਸਨ ਅੱਜ ਕੱਲ੍ਹ ਦੇ ਮੌਡਰਨ ਜ਼ਮਾਨੇ ਵਿੱਚ ਭਾਵੇਂ ਕਈ ਤਰ੍ਹਾਂ ਦਾ ਫੈਸ਼ਨ ਕਈ ਤਰ੍ਹਾਂ ਦੇ ਸ਼ੂਜ ਬੂਟ ਆ ਗਏ ਹਨ ਪਰ ਜੋ ਟੌਹਰ ਪੰਜਾਬੀ ਜੁੱਤੀ ਨਾਲ ਬਣਦੀ ਹੈ ਉਹ ਕਿਸੇ ਹੋਰ ਬੂਟਾਂ ਨਾਲ ਨਹੀਂ ਬਣਦੀ ਪੰਜਾਬੀ ਜੁੱਤੀ ਬਣਾਉਣਾ ਵੀ ਇੱਕ ਕਲਾ ਹੈ ਪੰਜਾਬੀ ਜੁੱਤੀ ਦਾ ਸਾਰਾ ਕੰਮ ਹੱਥੀਂ ਕੀਤਾ ਜਾਂਦਾ ਹੈ ਇਸ ਦੀ ਕਢਾਈ ਮੀਨਾਕਾਰੀ ਸਭ ਕੁਛ ਹੱਥ ਨਾਲ ਕੀਤਾ ਜਾਂਦਾ ਹੈ ਪੰਜਾਬ ਵਿੱਚ ਮੁਕਤਸਰ ਜ਼ਿਲ੍ਹੇ ਦੀ ਪੰਜਾਬੀ ਜੁੱਤੀ ਬਹੁਤ ਮਸ਼ਹੂਰ ਹੈ ਪੰਜਾਬੀ ਜੁੱਤੀ ਵਿੱਚ ਕਈ ਤਰ੍ਹਾਂ ਦੀ ਕਿਸਮਾਂ ਦੀ ਜੁੱਤੀ ਹੁੰਦੀ ਹੈ ਜਿਵੇਂ ਕਿ ਤਿੱਲੇ ਵਾਲੀ ਜੁੱਤੀ ਮੀਨਾਕਾਰੀ ਵਾਲੀ ਜੁੱਤੀ ਖੁੱਸਾ ਆਦਿ ਸਾਰੇ ਪੰਜਾਬੀ ਜੁੱਤੀ ਦੀਆਂ ਕਿਸਮਾਂ ਹਨ ਪੰਜਾਬੀ ਜੁੱਤੀ ਬਣਾਉਣਾ ਵੀ ਇੱਕ ਕਲਾ ਹੈ